ਅੱਜ ਭਾਰਤ ਵਿੱਚ ਵਾਤਾਵਰਣ ਦੀ ਸਮੱਸਿਆ ਦਿਨੋ ਦਿਨ ਵੱਧ ਰਹੀ ਹੈ ਜਿਵੇਂ ਸਾਨੂੰ ਪਤਾ ਹੀ ਹੈ ਕਿ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਭਾਰਤ ਨੂੰ ਹਰ ਵਪਾਰੀ ਹਰ ਦੇਸ਼ ਮੰਡੀ ਦੇ ਰੂਪ ਵਿੱਚ ਦੇਖਦਾ ਇਸ ਕਰਕੇ ਇੱਥੇ ਖੇਤੀ ਦਾ ਪੱਧਰ ਘੱਟ ਰਿਹਾ ਕਿਉਂਕਿ ਕਲੋਨੀਆਂ ਕੱਟੀਆਂ ਜਾ ਰਹੀਆਂ ਨ ਵੱਡੇ ਵੱਡੇ ਮਾਲਜ਼ ਉਸਾਰੇ ਜਾ ਰਹੇ ਹਨ ਅਤੇ ਮਾਲਸ ਔਰ ਕਲੋਨੀਆਂ ਕਿੱਥੇ ਬਣਨ ਗੀਆਂ ਧਰਤੀ 'ਤੇ ਅਤੇ ਧਰਤੀ ਦੇ ਜਿੰਨੇ ਵੀ ਸਾਡੇ ਖੇਤਰੀ ਇਲਾਕਾ ਹੈ ਜਾਂ ਖੇਤੀ ਦਾ ਇਲਾਕਾ ਹੈ ਵਣਾ ਦਾ ਇਲਾਕਾ ਹੈ ਜੰਗਲਾਂ ਦਾ ਇਲਾਕਾ ਜੰਗਲ ਕੱਟੇ ਜਾ ਰਹੇ ਹੈ ਜਦੋਂ ਜੰਗਲ ਕੱਟੇ ਜਾਣਗੇ ਤਾਂ ਮਿੱਟੀ ਵੀ ਖਤਮ ਹੋਏਗੀ ਮਿੱਟੀ ਖਤਮ ਹੋਏਗੀ ਉਹਦੇ ਨਾਲ ਸਾਡੇ ਵਾਤਾਵਰਣ 'ਤੇ ਵੀ ਪ੍ਰਭਾਵ ਪੈਂਦਾ ਸਮੇਂ ਸਿਰ ਮੀਂਹ ਨਾ ਪੈਣਾ ਸਮੇਂ ਸਿਰ ਰੁੱਤਾਂ ਦੇ ਵਿੱਚ ਬਦਲਾਅ ਨਾ ਆਉਣਾ ਆਪਾਂ ਪਿਛਲੇ ਦਸ ਸਾਲਾਂ ਤੋਂ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਗਰਮੀ ਸਮੇਂ ਪਰ ਗਰਮੀ ਨਹੀਂ ਪੈਂਦੀ ਸਰਦੀ ਸਮੇਂ 'ਤੇ ਸਰਦੀ ਨੀ ਪੈਂਦੀ ਇਸ ਕਰਕੇ ਇਹਦਾ ਹੋਰ ਵੀ ਕੀ ਕਾਰਨ ਜਿਵੇਂ ਵਧਦੀ ਆਬਾਦੀ ਵੱਧਦੀ ਆਬਾਦੀ ਦੇ ਕਾਰਨ ਵੀ ਸਾਡੇ 'ਚ ਪਲਿਊਸ਼ਨ ਬਹੁਤ ਵੱਧ ਰਿਹਾ ਕਿਉਂਕਿ ਸਾਡੇ ਜ਼ਿਆਦਾਤਰ ਲੋਕ ਰੱਬ ਨੂੰ ਮੰਨਣ ਦੀ ਥਾਂ 'ਤੇ ਅੱਜ ਕਲ੍ਹ ਅਡੰਬਰਾਂ ਦੇ ਵਿੱਚ ਜ਼ਿਆਦਾ ਪੈ ਗਏ ਨਦੀਆਂ ਨਾਲਿਆਂ ਦੇ ਵਿੱਚ ਧਾਗੇ ਤਵੀਤ ਮੌਲੀਆਂ ਨਾਰੀਅਲ ਸਿੱਟ ਸਿਟ ਕੇ ਸਾਡੇ ਪੀਣ ਵਾਲੇ ਜਲ ਨੂੰ ਦੂਸ਼ਿਤ ਕਰ ਰਹੇ ਨੇ ਬਾਬੇ ਨਾਨਕ ਨੇ ਜਲ ਨੂੰ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਕਿਹਾ ਇਸ ਕਰਕੇ ਸਾਨੂੰ ਸਭ ਨੂੰ ਲੋੜ ਹੈ ਕਿ ਰਲ ਮਿਲ ਕੇ ਆਪਾਂ ਇਹਨਾਂ ਅਡੰਬਰਾਂ ਨੂੰ ਛੱਡ ਕੇ ਭਾਰਤ ਦੇ ਵਾਤਾਵਰਣ ਨੂੰ ਬਚਾਈਏ ਭਾਰਤ ਦੀਆਂ ਨਦੀਆਂ ਨੂੰ ਬਚਾਈਏ ਭਾਰਤ ਦੇ ਪੌਣ ਪਾਣੀ ਨੂੰ ਬਚਾਈਏ ਕੁੱਲ ਮਿਲਾ ਕੇ ਮਾਨਵਤਾ ਨੂੰ ਬਚਾਈਏ ਕਿਉਂਕਿ ਜੇ ਇਹ ਸਭ ਚੀਜ਼ਾਂ ਬਚਣਗੀਆਂ ਤਾਂ ਮਾਨਵਤਾ ਅਤੇ ਮਾਨਵ ਤਾਂ ਹੀ ਬਚੇਗਾ ਆਪਾਂ ਰਲ ਮਿਲ ਕੇ ਆਓ ਹੰਬਲਾ ਮਾਰੀਏ ਉਪਰਾਲਾ ਕਰੀਏ ਵੀ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਦਾ ਭਵਿੱਖ ਵਾਤਾਵਰਣ ਪੋਲਿਊਸ਼ਨ ਵਾਤਾਵਰਣ ਤੋਂ ਮੁਕਤ ਹੋ ਕੇ ਮਿਲੇ ਉਹਨਾਂ ਨੂੰ